ਯੂ ਐੱਫ ਓ ਹੁੰਦੇ ਆ ਜੀ ਜਿਹਨੂੰ ਆਪਾਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਬਈ ਉੱਡਣ ਦਸਤਰੀ ਹਾਲਾਂਕਿ ਮੈਂ ਨਿੱਜੀ ਤੌਰ 'ਤੇ ਯੂ ਐੱਫ ਓ ਕਦੇ ਵੀ ਨਹੀਂ ਵੇਖਿਆ ਪਰ ਸੁਣਿਆ ਜ਼ਰੂਰ ਹੈ ਇਹਦੇ ਬਾਰੇ ਕੁਝ ਗੱਲਾਂ ਨੂੰ ਆਪਾਂ ਸਾਰੇ ਜਾਣਦੇ ਹਾਂ ਜਿਵੇਂ ਕਿ ਦਹਾਕਿਆਂ ਤੋਂ ਦੁਨੀਆ ਭਰ ਵਿੱਚ ਯੂ ਐੱਫ ਓ ਵੇਖਣ ਦੀ ਰਿਪੋਟ ਕੀਤੀ ਗਈ ਹੈ ਬਈ ਕੁਛ ਕਹਿੰਦੇ ਨੇ ਕੁਦਰਤੀ ਵਰਤਾਰੇ ਬਈ ਕਈ ਕਹਿੰਦੇ ਨੇ ਹਵਾਈ ਜਹਾਜ਼ ਹੈ ਜਾਂ ਹੋਰ ਜਾਣੀਆਂ ਜਾਂਦੀਆਂ ਵਸਤੂਆਂ ਦੀ ਜਿਵੇਂ ਅਤੇ ਅਮਰੀਕਾ ਨੇ ਵੀ ਇਹਦੇ ਲਈ ਕਾਫ਼ੀ ਰਿਸਰਚਰ ਲਗਾਏ ਹੋਏ ਨੇ ਬਈ ਇਹ ਇਹਦਾ ਨਵੀਂ ਦਿਲਚਸਪੀ ਪੈਦਾ ਕਰ ਰਿਹਾ ਬਈ ਯੂ ਐੱਫ ਓ ਦੇ ਨਾਂ 'ਤੇ ਅਤੇ ਹੋਰ ਗ੍ਰਹਿ ਦੇ ਜੀਵਨ ਦੇ ਬਾਰੇ ਜੇ ਆਪਾਂ ਗੱਲ ਕਰੀਏ ਅਤੇ ਉਹਦੇ ਬਾਰੇ ਅਸੀਂ ਹਾਲੇ ਕੁਛ ਵੀ ਨਹੀਂ ਕਹਿ ਸਕਦੇ ਹਾਂ ਹਾਲਾਂਕਿ ਵਿਗਿਆਨੀ ਖੋਜ ਕਰੀ ਜਾਂਦੇ ਹਾਂ ਬਈ ਜਿਵੇਂ ਆਪਣੇ ਭਾਰਤ ਦਾ ਵੀ ਇੱਕ ਮਿਸ਼ਨ ਮੰਗਲ ਦੇ ਨਾਂ 'ਤੇ ਚੱਲਿਆ ਸੀ ਅਤੇ ਸਾਡੇ ਸੋਰ ਮੰਡਲ ਦੇ ਅੰਦਰ ਮੰਗਲ 'ਤੇ ਇੱਕ ਇਨ੍ਹਾਂ ਨੇ ਰਾਕਿਟ ਭੇਜਿਆ ਹੈ ਅਤੇ ਉਹ ਧਰਤੀ 'ਤੇ ਵਾਪਸ ਆਉਣ ਲਈ ਚਟਾਨ ਦੇ ਨਮੂਨੇ ਇਕੱਠੇ ਕਰ ਰਹੇ ਹੈ ਤਾਂ ਜਿਹੜੇ ਆਪਣੇ ਵਿਗਿਆਨੀ ਜੀਵਨ ਦੇ ਸੰਕੇਤਾਂ ਲਈ ਉਨ੍ਹਾਂ ਦੀ ਜਾਂਚ ਕਰ ਸਕਣ ਅਤੇ ਹੋਰ ਅਮਰੀਕਾ ਵੀ ਲੱਗਿਆ ਹੋਇਆ ਹੈ ਆਲੇ ਦੁਆਲੇ ਗ੍ਰਹਿਆਂ ਨੂੰ ਅਤੇ ਉਹਦੇ ਵਾਯੂਮੰਡਲ ਦੇ ਬਣਤਰ ਦਾ ਪੱਥਰ ਲਗਾਉਣ ਲਈ ਤਾਂ ਹਾਲੇ ਵੀ ਆਪਾਂ ਕੁਛ ਪੱਕੇ ਤੌਰ 'ਤੇ ਨਹੀਂ ਕਹਿ ਸਕਦੇ ਬਈ ਕਿ ਓਥੇ ਵੀ ਜੀਵਨ ਹੈਗਾ ਕਿ ਨਹੀਂ ਹੈਗਾ